ਮੇਰੇ ਮਨਪਸੰਦ ਪਕਵਾਨ ਖੀਰ ਪੂੜੇ ਹਨ ਕਿਉਂਕਿ ਮੈਨੂੰ ਖੀਰ ਪੂੜੇ ਬਹੁਤ ਹੀ ਪਸੰਦ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਕਚੋਰੀਆਂ ਦਹੀਂ ਦੇ ਨਾਲ ਕਚੋਰੀਆਂ ਬਹੁਤ ਹੀ ਮਨ ਮਨ ਮਨਭਾਉਂਦੀਆਂ ਬਣਾਉਂਦੀ ਹਾਂ ਕਿਉਂਕਿ ਇਹ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਹਨ ਅਤੇ ਮੈਂ ਹਰੇਕ ਬਰਸਾਤ ਵਿੱਚ ਬਣਾਉਂਦੀ ਰਹਿੰਦੀ ਹਾਂ ਅਤੇ ਅਤੇ ਸਾਰਾ ਪਰਿਵਾਰ ਖੁਸ਼ ਹੋ ਕੇ ਖਾਂਦਾ ਹੈ